ਸਤਿ ਸ਼੍ਰੀ ਅਕਾਲ ਜੀ ਬਾਈਕਿੰਗ ਜਿਸ ਨੂੰ ਪਹਿਲਾਂ ਮੋਟਰਸਾਈਕਲ ਸਵਾਰਾਂ ਦੀ ਮੰਜ਼ਿਲ ਤੱਕ ਪਹੁੰਚਣ ਲਈ ਵਰਤਿਆ ਜਾਂਦਾ ਸੀ ਪਰ ਹੁਣ ਦੁਨੀਆ ਵਿੱਚ ਇੱਕ ਵਿਸ਼ੇਸ਼ ਸਮੂਹ ਬਣਾ ਚੁੱਕਾ ਇਸ ਦੇ ਅਨਜਾਬੀ ਬਾਈਕਿੰਗ ਦੀ ਦੁਨੀਆ ਵਿੱਚੋਂ ਵੱਲੋਂ ਦਾਖਲ ਹੋਣਾ ਮੁਲਾਜ਼ਮ ਨਹੀਂ ਸੀ ਬਲਕਿ ਜੀਵਨ ਸ਼ੈਲੀ ਬਣ ਗਈ ਹੈ ਬਾਈਕਿੰਗ ਸਮਰੱਥਾ ਸ਼੍ਰੀ ਟੀਕਾਕਾਰੀ ਰਸਤੇ ਵਿੱਚ ਦੇ ਸਬੰਧਤ ਵਿੱਚ ਇੱਕ ਨਵੇਂ ਦੇਸ਼ੀਕੋਂਟ ਦੇਸ਼ੀਕੋਂਟ ਲਈ ਰਚਿਤ ਹੈ ਬਾਈਕਾਟ ਯਾਤਰਾਵਾਂ ਨੂੰ ਅਤੇ ਉਹਨਾਂ ਦੇ ਮੰਜ਼ਿਲਾਂ ਨੂੰ ਗੁਰਮੁਖੀ ਵਿੱਚ ਅਨੁਵਾਦ ਕਰਨ ਦੇ ਲਈ ਇਹ ਦੁਨਿਆਵੀਂ ਪਲਟਾਂ ਨੂੰ ਸਾਂਝਾ ਕਰਦੇ ਹਨ ਬਾਈਕਿੰਗ ਦੇ ਮੂਲ ਕਬਾੜ ਨੂੰ ਛੱਡ ਕੇ ਰੱਖ ਕੇ ਅਤੇ ਇਸ ਨੂੰ ਇੱਕ ਅਣਬਤ ਸੰਗੀਤ ਅਤੇ ਸਹਾਇਕ ਸੰਰਚਨਾ ਬਣਾ ਦਿੱਤਾ ਹੈ ਬਾਈਕਿੰਗ ਸੰਤੁਲਨ ਅਤੇ ਆਤਮ ਵਿਸ਼ਵਾਸ ਨੂੰ ਬਢਾਵਾ ਤੇਰਾ 'ਤੇ ਪਾ ਕੇ ਸਵਾਰਾਂ ਨੂੰ ਸਾਂਝਾ ਕਰਨ ਦਾ ਇੱਕ ਪ੍ਰੋਫੈਸ਼ਨ ਬਣ ਗਈ ਹੈ ਕਿ ਕਾਰਗਰ ਤਰੀਕੇ ਨਾਲ ਉਹਨਾਂ ਨੇ ਖੁਦ ਨੂੰ ਜੀਵਨ ਦੇ ਸਾਰੇ ਪਹਿਲਾਵਾਂ ਨੂੰ ਨਾਲ ਜੋੜਿਆ ਹੈ ਅਤੇ ਪ੍ਰੈਕਟੀਕਲ ਅਤੇ ਸ਼ੀਚੀ ਸ਼੍ਰੀ ਆਸ ਪ੍ਰਵਾਸ ਦੇ ਸਾਥ ਹਰ ਯਾਤਰਾ ਨੂੰ ਇੱਕ ਦਿਲਚਸਪ ਅਤੇ ਮੌਜ ਮੌਜ ਮਸਤੀ ਬਣਾ ਦਿੱਤਾ ਹੈ ਧੰਨਵਾਦ ਜੀ